ਸਭ ਤੋਂ ਪਹਿਲਾਂ ਮੈਂ ਸਤਲੁਜ ਪਬਲਿਕ ਸਕੂਲ ਹੁਸੈਨਪੁਰ ਤੋਂ ਆਪਣੀ ਬਾਰ੍ਹਵੀਂ ਪੂਰੀ ਕੀਤੀ ਸਕੂਲ ਵਿੱਚ ਵਿੱਚ ਮੇਰੇ ਬਹੁਤ ਵਧੀਆ ਨੰਬਰ ਆਏ ਇਕਾਨਵੇਂ ਪਰਸੈਂਟ ਉਸ ਤੋਂ ਬਾਅਦ ਮੈਂ ਮੈਰਿਟ ਲਿਸਟ ਵਿੱਚ ਗਵਰਮੈਂਟ ਸਰਕਾਰੀ ਕਾਲਜ ਰੂਪਨਗਰ ਵਿੱਚ ਮੇਰਾ ਦਾਖਲਾ ਹੋਇਆ ਹੋਇਆ ਸਰਕਾਰੀ ਕਾਲਜ ਵਿੱਚ ਜਾ ਕੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਲੱਗਿਆ ਜਿਵੇਂ ਅਸੀਂ ਅਸੀਂ ਆਈ ਆਈ ਟੀ ਕਰ ਸਕਦੇ ਹਾਂ ਕਰ ਸਕਦੇ ਹਾਂ ਫ਼ੋਨ ਰਾਹੀਂ ਕਿੱਦਾਂ ਆਪਣੇ ਆਪ ਨੂੰ ਸੁਚੇਤ ਰੱਖ ਸਕਦੇ ਹਾਂ ਕਾਲਜ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ ਜਿਵੇਂ ਅਸੀਂ ਬਹੁਤ ਸਾਰੇ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ ਅਤੇ ਬਹੁਤ ਸਾਰੀ ਪ੍ਰਤਿਯੋਗਿਤਾ ਜਿੱਤੀਆਂ ਵੀ ਹਨ